ਹਾਂਜੀ ਪੰਜਾਬੀ ਭਾਸ਼ਾ ਦੀ ਵਰਤੋਂ ਕਾਫ਼ੀ ਕੀਤੀ ਜਾ ਰਹੀ ਹੈ ਅੱਜ ਕੱਲ੍ਹ ਤਾਂ ਇਹ ਹੁਣ ਤੋਂ ਨਹੀਂ ਮਤਲਬ ਸ਼ੁਰੂ ਤੋਂ ਹੀ ਜਦੋਂ ਤੋਂ ਮਤਲਬ ਆਪਣਾ ਦੇਸ਼ ਅਜ਼ਾਦ ਹੋਇਆ ਅਤੇ ਉਦੋਂ ਉਦੋਂ ਤੋਂ ਹੀ ਵੇਖੀ ਜਾ ਰਹੀ ਹੈ ਕਿ ਜਿੱਦਾਂ ਸ਼ਿਵ ਕੁਮਾਰ ਬਟਾਲਵੀ ਹੋ ਗਿਆ ਜਾਂ ਕਈ ਹੋਰ ਅਦਾਕਾਰ ਜਾਂ ਸਿੰਗਰ ਰਹਿ ਚੁੱਕੇ ਲੇਖਕ ਰਹਿ ਚੁੱਕੇ ਜਿਹਨਾਂ ਨੇ ਕਾਫ਼ੀ ਪੰਜਾਬੀ ਭਾਸ਼ਾ ਨੂੰ ਪ੍ਰਮੋਟ ਕੀਤਾ ਅਤੇ ਹੁਣ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਜਿੰਨਾ ਜੋ ਕਿ ਮਿਲ ਰਿਹਾ ਪੰਜਾਬੀ ਨੂੰ ਇੰਨਾਂ ਕਦੇ ਵੀ ਨਹੀਂ ਮਿਲਿਆ ਹੈਗਾ ਇਹ ਵੀ ਪੋਸੀਬਲ ਹੋਇਆ ਸਿੱਧੂ ਮੂਸੇਆਲਾ ਦਲਜੀਤ ਦੋਸਾਂਝ ਸਰਤਿੰਦਰ ਸਰਤਾਜ ਕਰਨ ਔਜਲਾ ਅਤੇ ਕੋਈ ਇੱਕ ਬਹੁਤ ਸਾਰੇ ਆਰਟਿਸਟ ਆ ਪੰਜਾਬੀ ਜੋ ਕਿ ਇੰਰਟਨੈਸ਼ਨਲੀ ਕੋਲੈਬਰੇਟ ਕਰਦੇ ਹੈ ਸਿੰਗਰਸ ਅਤੇ ਆਰਟਿਸਟ ਨਾਲ ਅਤੇ ਸਾਡੀ ਪੰਜਾਬੀ ਭਾਸ਼ਾ ਨੂੰ ਅੱਗੇ ਪ੍ਰਮੋਟ ਕਰਦੇ ਹੈ ਹੁਣ ਜੇਕਰ ਦੇਖਿਆ ਜਾਵੇ ਤਾਂ ਕੈਨੇਡਾ ਵਿੱਚ ਵੀ ਪੰਜਾਬੀਆਂ ਨੇ ਬਹੁਤ ਹੀ ਵਧੀਆ ਕੰਮ ਕਰ ਰਹੇ ਆ ਪੰਜਾਬੀ ਨੂੰ ਪ੍ਰਮੋਟ ਕੀਤੀ ਜਾ ਰਹੀ ਹੈ ਅਤੇ ਦੇਖਿਆ ਜਾਵੇ ਤਾਂ ਬੋਲੀਵੁੱਡ ਵਿੱਚ ਵੀ ਜਿੰਨੇ ਵੀ ਸਿੰਗਰ ਹੈਗੇ ਹੈ ਜ਼ਿਆਦਾਤਰ ਪੰਜਾਬੀ ਗਾਣਿਆਂ 'ਤੇ ਰਿਮਿਕਸ ਕਰਦੇ ਹੈ ਅਤੇ ਪੰਜਾਬੀ ਨੂੰ ਹੀ ਪ੍ਰਮੋਟ ਕਰਦੇ ਹੈ ਅਤੇ ਪੰਜਾਬੀ ਦਾ ਜੋ ਤੁਸੀਂ ਕਹਿ ਰਹੇ ਹੋ ਜੋ ਦੌਰ ਆ ਰਿਹਾ ਪੰਜਾਬੀ ਭਾਸ਼ਾ ਦਾ ਜੋ ਦੌਰ ਆ ਰਿਹਾ ਕਾਫ਼ੀ ਜ਼ਿਆਦਾ ਪੰਜਾਬੀ ਬੋਲੀ ਜਾ ਰਹੀ ਹੈ ਅਤੇ ਪੰਜਾਬੀ ਸਿੰਗਰ ਜਿੱਦਾਂ ਸ਼ੁੱਭ ਹੋ ਗਿਆ ਅੱਜ ਕੱਲ੍ਹ ਨਵੇਂ ਜਿਹੜੇ ਆਰਟਿਸਟ ਆ ਰਹੇ ਹੈ ਇਹ ਕਾਫੀ ਵੱਧ ਚੜ੍ਹ ਕੇ ਓਹ ਓਹ ਦੂਜੇ ਰਾਜਿਆਂ ਵਿੱਚ ਵੀ ਫੇਮਸ ਹੋ ਰਹੇ ਆ ਅਤੇ ਦੂਜੀ ਗੱਲ ਕੀਤੀ ਜਾਵੇ ਤਾਂ ਪੰਜਾਬੀ ਸੱਭਿਆਚਾਰ ਵੀ ਕਾਫ਼ੀ ਪ੍ਰਮੋਟ ਹੁੰਦਾ ਜੇਕਰ ਤੁਸੀਂ ਬੋਲੀਵੁੱਡ ਜਾਂ ਹੋਲੀਵੁੱਡ ਵੀ ਦੇਖਿਆ ਜਾਵੇ ਤਾਂ ਕਾਫ਼ੀ ਪੰਜਾਬੀ ਪੰਜਾਬ ਵਿੱਚ ਆ ਕੇ ਅਤੇ ਓਥੋਂ ਦੇ ਖੇਤ ਦੀਆਂ ਓਥੋਂ ਦੇ ਸੱਭਿਆਚਾਰ ਦੇ ਉੱਤੇ ਵੀਡੀਓਗ੍ਰਾਫੀ ਅਤੇ ਫੋਟੋਗ੍ਰਾਫੀ ਕਰਕੇ ਜਾਂਦੇ ਹੈ ਜੋ ਕਿ ਕਾਫ਼ੀ ਵੱਡੀ ਚੀਜ਼ ਹੈ ਜਿਸ ਦੇ ਨਾਲ ਪੰਜਾਬੀ ਇੰਡਸਟਰੀ ਬੂਸਟ ਹੋ ਰਹੀ ਹੈ